ਸਾਡੇ ਖੇਤਰ ਵਿੱਚ ਤਰ੍ਹਾਂ ਤਰ੍ਹਾਂ ਦੇ ਪੈਟਰਨਾਂ ਦੀ ਬੁਣਾਈ ਅਤੇ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੀ ਸਿਲਾਈ ਕੀਤੀ ਜਾਂਦੀ ਹੈ ਇਹ ਕਾਫ਼ੀ ਤਰ੍ਹਾਂ ਨਾਲ ਬੁਣਾਈ ਕੀਤੀ ਜਾਂਦੀ ਹੈ ਜਿਵੇਂ ਸਿਲਾਈਆਂ ਨਾਲ ਅਤੇ ਕਰੋਸ਼ੀਏ ਨਾਲ ਅਤੇ ਬੁਣਾਈ ਕਰਣ ਵਾਲੀ ਉੱਨ ਵੀ ਕਾਫ਼ੀ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਤਿੰਨ ਤੰਦਿਆਂ ਵਾਲੀ ਉੱਨ ਇੱਕ ਤੰਦਿਆਂ ਵਾਲੀ ਉੱਨ ਮੋਟੀ ਉੱਨ ਪਤਲੀ ਉੱਨ ਅਤੇ ਹੋਰ ਵੀ ਕਈ ਕਰੋਸ਼ੀਏ ਨਾਲ ਬੈਡ ਦੀਆਂ ਚਾਦਰਾਂ ਗਿਲਾਫ਼ ਤਖਤਪੋਸ਼ ਅਤੇ ਹੋਰ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਅਤੇ ਸਿਲਾਈ ਨਾਲ ਸਿਰਾਣਿਆਂ ਦੇ ਕਵਰ ਬੈਡਸ਼ੀਟਾਂ ਅਤੇ ਹੋਰ ਵੀ ਕਾਫ਼ੀ ਤਰ੍ਹਾਂ ਦੇ ਪੈਟਰਨਾਂ ਦੀ ਸਿਲਾਈ ਅਤੇ ਬੁਣਾਈ ਹੁੰਦੀ ਹੈ ਮੈਂ ਕਦੇ ਬੁਣਾਈ ਅਤੇ ਸਿਲਾਈ ਕਦੇ ਨਹੀਂ ਕੀਤੀ ਪਰੰਤੂ ਮੇਰੇ ਮਾਤਾ ਜੀ ਕਰੋਸ਼ੀਏ ਦੀ ਬੁਣਾਈ ਕਰਦੇ ਹਨ ਜੋ ਕਿ ਬਹੁਤ ਰਿਵਾਇਤੀ ਹੈ ਅਤੇ ਇਹ ਕਾਫ਼ੀ ਸਹਾਇਕ ਵੀ ਹੈ ਇਹ ਇੱਕ ਰੁਜ਼ਗਾਰ ਦਾ ਵੀ ਸਾਧਨ ਹੈ ਧੰਨਵਾਦ